ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਲੋਕਾਂ ਨੂੰ ਪੰਜਾਬੀ ਫਿਲਮਾਂ ਵੇਖਣ ਦਾ ਬਹੁਤ ਜ਼ਿਆਦਾ ਹੀ ਸ਼ੌਂਕ ਹੈ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਐਕਸ਼ਨ ਕੋਮੇਡੀ ਫਨੀ ਸੀਨ ਬਹੁਤ ਕੁਛ ਹੁੰਦਾ ਹੈ ਜੋ ਕਿ ਇੱਕ ਪਰਿਵਾਰ ਪੂਰਾ ਬੈਠ ਕੇ ਦੇਖ ਸਕਦਾ ਹੈ ਸਪੈਸ਼ਲੀ ਜਦੋਂ ਵੀ ਕੋਈ ਨਵੀਂ ਫਿਲਮ ਆਉਂਦੀ ਹੈ ਤਾਂ ਉਸ ਨੂੰ ਦੇਖਣ ਦੇ ਲਈ ਪੰਜਾਬੀ ਲੋਕ ਬਹੁਤ ਉਤਾਵਲੇ ਹੁੰਦੇ ਹਨ ਅਤੇ ਉਹ ਥੀਏਟਰ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਵੇਂ ਕਿ ਬਿਗ ਸਿਨੇਮਾ ਸਿਨੇਮਾਜ਼ ਹੈ ਇਸ ਦੀ ਟਿਕਟ ਬਹੁਤ ਹੀ ਜ਼ਿਆਦਾ ਹਾਈ ਹੈ ਪਰ ਇਸ ਦੀ ਸਕਰੀਨ ਰਿਵਿਊ ਬਹੁਤ ਹੀ ਵਧੀਆ ਹੈ ਇੱਥੇ ਫਿਲਮ ਬਹੁਤ ਹੀ ਕੰਫਰਟੇਬਲ ਜੋਨ ਦੇ ਵਿੱਚ ਬੈਠ ਕੇ ਅਸੀਂ ਦੇਖ ਸਕਦੇ ਹਾਂ ਇੱਥੋਂ ਦੀ ਫੂਡ ਕੁਆਲਿਟੀ ਵੀ ਬਹੁਤ ਜ਼ਿਆਦਾ ਹੀ ਵਧੀਆ ਹੈ ਪਰ ਇੱਥੋਂ ਜਿਹੜਾ ਪਰ ਇੱਥੋਂ ਦਾ ਪ੍ਰਾਈਜ ਬਹੁਤ ਜ਼ਿਆਦਾ ਹੀ ਹਾਈ ਹੈ ਦੂਜੇ ਨੰਬਰ 'ਤੇ ਆਉਂਦਾ ਐਸ ਆਰ ਐਸ ਸਿਨਮਾਸ ਇੱਥੋਂ ਦੀ ਵੀ ਜਿਹੜੀ ਸਾਡੀ ਸਕਰੀਨ ਕੁਆਲਟੀ ਹੈ ਬਹੁਤ ਜ਼ਿਆਦਾ ਹੀ ਵਧੀਆ ਹੈ ਸਾਨੂੰ ਫਰੰਟ ਸੀਟ ਵੀ ਆਸਾਨੀ ਨਾਲ ਮਿਲ ਜਾਂਦੀ ਹੈ ਅਗਰ ਆਪਾਂ ਜਲਦੀ ਟਿਕਟ ਲੈ ਲਈਏ ਤਾਂ ਫੋਲਡ ਕੁਆਲ ਟੀ ਵੀ ਬੈਸਟ ਹੈ ਇਸ ਦੀ ਟਿਕਟ ਨੋਰਮਲ ਹੀ ਹੈ ਪਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਲੋਕਾਂ ਨੂੰ ਇਕੱਠੇ ਰਹਿਣਾ ਬਹੁਤ ਇਕੱਠੇ ਰਹਿ ਕੇ ਕੋਈ ਵੀ ਕੰਮ ਕਰਨ 'ਚ ਜ਼ਿਆਦਾ ਦਿਲਚਸਪੀ ਆਉਂਦੀ ਹੈ ਉਹ ਪੈਸੇ ਵੱਲ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦੇ ਜਦੋਂ ਵੀ ਉਹਨਾਂ ਨੂੰ ਖੁਸ਼ੀ ਦਾ ਮੌਕਾ ਮਿਲੇ ਤਾਂ ਉਹ ਆਪਣੀ ਖੁਸ਼ੀ ਨੂੰ ਪੂਰਾ ਇੰਜੋਏ ਕਰਦੇ ਹਨ ਤਾਂ ਇਹੀ ਖ਼ਾਸੀਅਤ ਹੈ ਕਿ ਪੰਜਾਬੀ ਖੁਸ਼ ਰਹਿੰਦੇ ਹਨ ਅਤੇ ਜਦੋਂ ਵੀ ਉਹਨਾਂ ਨੂੰ ਫਿਲਮ ਦੇਖਣ ਦਾ ਜੀਅ ਕਰੇ ਤਾਂ ਉਹ ਸਿਨੇਮਾ ਵਿੱਚ ਜਾ ਕੇ ਫਿਲਮ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ ਚਾਹੇ ਉਸ ਦੇ ਪੈਸੇ ਘੱਟ ਹੋਣ ਚਾਹੇ ਉਸ ਦੇ ਪੈਸੇ ਵੱਧ ਹੋਣ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ